ਮੇਰਾ ਮਨ ਪਸੰਦੀਦਾ ਕਲਾਕਾਰ ਸਤਿੰਦਰ ਸਰਤਾਜ ਹੈ ਮੈਨੂੰ ਉਹਨਾਂ ਦਾ ਹਰੇਕ ਗਾਣਾ ਬਹੁਤ ਹੀ ਜ਼ਿਆਦਾ ਪਸੰਦ ਹੈ ਉਹਨਾਂ ਦੇ ਹਰ ਇੱਕ ਗੀਤ ਵਿੱਚ ਬਹੁਤ ਹੀ ਜ਼ਿਆਦਾ ਭਾਵਨਾ ਦਾ ਪ੍ਰਗਟਾਵਾ ਹੁੰਦਾ ਹੈ ਕਿਤੇ ਤਾਂ ਉਹ ਪਿਆਰ ਬਾਰੇ ਦੱਸਦੇ ਹਨ ਕਿਤੇ ਉਹ ਦੱਸਦੇ ਹਨ ਕਿ ਧੀਆਂ ਨੂੰ ਸਾਨੂੰ ਬਚਾਉਣਾ ਚਾਹੀਦਾ ਹੈ ਔਰ ਕਿਤੇ ਉਹ ਵੱਡਿਆਂ ਦਾ ਆਦਰ ਸਤਿਕਾਰ ਚੰਗੀਆਂ ਗੱਲਾਂ ਸਿਖਾਉਂਦੇ ਹਨ ਉਹਨਾਂ ਦੇ ਹਰ ਗੀਤ ਵਿੱਚ ਕੁਛ ਨਾ ਕੁਛ ਸਿੱਖਿਆ ਸਾਨੂੰ ਮਿਲਦੀ ਹੈ ਉਹਨਾਂ ਦੀ ਆਵਾਜ਼ ਬਹੁਤ ਹੀ ਜ਼ਿਆਦਾ ਮਿੱਠੀ ਹੈ ਜਿਸ ਨੂੰ ਸੁਣਨ ਨਾਲ ਬੰਦੇ ਦਾ ਕਈ ਪ੍ਰੇਸ਼ਾਨੀਆਂ ਤੋਂ ਮਨ ਉੱਠ ਜਾਂਦਾ ਹੈ ਅਤੇ ਉਹਨਾਂ ਦੇ ਸੰਗੀਤ ਸੁਣਨ ਨਾਲ ਮੇਰਾ ਮਨ ਬਹੁਤ ਹੀ ਜ਼ਿਆਦਾ ਵਧੀਆ ਹੋ ਜਾਂਦਾ ਹੈ ਮੈਨੂੰ ਬੜਾ ਹੀ ਵਧੀਆ ਫੀਲ ਹੁੰਦਾ ਹੈ ਜਦੋਂ ਵੀ ਮੈਂ ਉਹਨਾਂ ਦੇ ਸੰਗੀਤ ਸੁਣਦੀ ਹਾਂ ਔਰ ਉਹਨਾਂ ਦਾ ਕਿਰਦਾਰ ਬਹੁਤ ਹੀ ਜ਼ਿਆਦਾ ਵਧੀਆ ਹੈ ਉਹਨਾਂ ਦਾ ਜੀਵਨ ਉਹਨਾਂ ਦਾ ਹਰ ਇੱਕ ਨਾਲ ਬੋਲ ਚਾਲ ਉਹ ਬੜੇ ਹੀ ਪਿਆਰ ਨਾਲ ਸਾਰਿਆਂ ਨਾਲ ਬੋਲਦੇ ਹਨ ਹਰ ਇੱਕ ਨੂੰ ਬੜੇ ਹੀ ਆਦਰ ਸਤਿਕਾਰ ਨਾਲ ਬੁਲਾਉਂਦੇ ਹਨ ਇਸ ਕਰਕੇ ਮੈਨੂੰ ਓਹਨਾਂ ਦਾ ਕਿਰਦਾਰ ਬਹੁਤ ਅੱਛਾ ਲੱਗਦਾ ਹੈ ਔਰ ਉਹ ਮੇਰੇ ਹਮੇਸ਼ਾਂ ਹੀ ਇੱਕ ਮਨਪਸੰਦੀਦਾਰ ਕਲਾਕਾਰ ਰਹਿਣਗੇ ਧੰਨਵਾਦ